ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਹੋਣ ਕਰਕੇ ਕਿਸੇ ਕੋਲ ਸਮੇਂ ਦੀ ਘਾਟ ਕਰਕੇ ਅੱਜ ਕੱਲ੍ਹ ਪਿੰਡ ਦੇ ਵਿੱਚੋਂ ਹੀ ਅਸੀਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਰੁਝਾਨ ਪੈਦਾ ਹੋ ਗਿਆ ਹੈ ਇਹ ਰੁਝਾਨ ਪੈਦਾ ਹੋਣ ਦਾ ਕਰਕੇ ਹਰ ਇੱਕ ਚੀਜ਼ ਨੂੰ ਸਾਨੂੰ ਆਪਣੇ ਪਿੰਡ ਉੱਤੇ ਹੀ ਨਿਰਭਰ ਹੋਣਾ ਪੈਂਦਾ ਹੈ ਸਾਡੇ ਪਿੰਡ ਵਿੱਚ ਕਰਿਆਨੇ ਦੀਆਂ ਬਹੁਤ ਵਧੀਆ ਵਧੀਆਂ ਦੁਕਾਨਾਂ ਹਨ ਜਿਸ ਤਰ੍ਹਾਂ ਸ਼ਹਿਰ ਦੇ ਮੁੱਲ 'ਤੇ ਹੀ ਉਹਨਾਂ ਤੋਂ ਸਮਾਨ ਮਿਲਦਾ ਹੈ ਉਸ ਤੋਂ ਬਾਅਦ ਮੈਡੀਕਲ ਦੀ ਸਹੂਲਤ ਹੈ ਮੈਡੀਕਲ ਦੇ ਵਿੱਚ ਵੀ ਰਜਿਸਟਰ ਡੋਕਟਰ ਹਨ ਸਾਡੇ ਪਿੰਡ ਵਿੱਚ ਮੈਡੀਕਲ ਸਹੂਲਤ ਵੀ ਹੈ ਹੋਰ ਲੈਬਰੇਟਰੀ ਵਗੈਰਾ ਹੈ ਜਿੱਥੋਂ ਅਸੀਂ ਟੈਸਟ ਕਰਵਾ ਸਕਦੇ ਹਾਂ ਸਾਨੂੰ ਹੋਰ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਇੰਟਰਨੈਟ ਕੈਫੇ ਵੀ ਹੈ ਜਿਸ ਤੋਂ ਅਸੀਂ ਛੋਟੇ ਮੋਟੇ ਫੋਰਮ ਜਾਂ ਹੋਰ ਕੁਛ ਇਸ ਤੋਂ ਇਲਾਵਾ ਇਲੈਕਟ੍ਰੀਸ਼ੀਅਨ ਦੀਆਂ ਦੁਕਾਨਾਂ ਹਨ ਉਹ ਦੁਕਾਨਾਂ ਦਾ ਸਾਨੂੰ ਇਹ ਫ਼ਾਇਦਾ ਹੈ ਕਿ ਜਿਨ੍ਹਾਂ ਨੇ ਦੁਕਾਨਾਂ ਪਾਈਆਂ ਹੋਈਆਂ ਨੇ ਉਹ ਖੁਦ ਵੀ ਐਕਸਪਰਟ ਹਨ ਇਸ ਕੰਮ ਦੇ ਉੱਤੇ ਉਹ ਨਾਲ ਸਮਾਨ ਵੇਚਦੇ ਹਨ ਨਾਲ ਆਪਣਾ ਕੰਮ ਕਰਦੇ ਹਨ ਘਰਾਂ ਦੇ ਵਿੱਚ ਵੀ ਜ਼ਰੂਰਤ ਪਵੇ ਕੋਈ ਮਕਾਨ ਬਣਾਉਣਾ ਹੋਵੇ ਤਾਂ ਵੀ ਉਹ ਉੱਥੇ ਕੰਮ ਕਰਦੇ ਹਨ ਆ ਕੇ ਇਸ ਤੋਂ ਇਲਾਵਾ ਮਨਿਆਰੀ ਦੀ ਗੱਲ ਕਰੀਏ ਤਾਂ ਮਨਿਆਰੀ ਦਾ ਹਰ ਇੱਕ ਚੀਜ਼ ਟਰੇਲਰਿੰਗ ਮਟੀਰੀਅਲ ਸਿਲਾਈ ਵਾਸਤੇ ਕੋਈ ਵੀ ਚੀਜ਼ ਦੀ ਜ਼ਰੂਰਤ ਪਵੇ ਉਹ ਵੀ ਇੱਥੋਂ ਮਿਲ ਜਾਂਦਾ ਹੈ ਹਰ ਇੱਕ ਚੀਜ਼ ਜੋ ਬੂਟ ਜੁਰਾਬਾਂ ਬਨੈਣਾ ਵਗੈਰਾ ਹਰ ਇੱਕ ਚੀਜ਼ ਇੱਥੋਂ ਆਸਾਨੀ ਨਾਲ ਮਿਲ ਜਾਂਦੀ ਹੈ